ਮੇਰਾ ਮਨ ਪਸੰਦ ਡਰਾਇੰਗ ਟੂਲ ਪੈਨਸਿਲ ਮਾਰਕਰ ਸਕੈਚਿਕ ਪੈਨ ਰੰਗ ਦੇ ਪੈਨਸਿਲ ਕੋ ਆਈ ਪੈਨਸਿਲ ਸਮਗਰੀ ਕਾਗਜ ਸਕੈਚ ਬੁੱਕ ਡਿਜੀਟਲ ਡਰਾਇੰਗ ਟੇਬਲਟ ਗਰਾਫਿਕਸ ਟੇਬਲਟ ਲੋਕ ਆਪਣੀਆਂ ਜ਼ਰੂਰਤਾਂ ਅਤੇ ਤਰਜੀਹਾਂ ਅਨੁਸਾਰ ਡਰਾਇੰਗ ਟੂਲ ਅਤੇ ਸਮੱਗਰੀ ਚੁਣਦੇ ਹਨ ਕੁਝ ਲੋਕ ਪਰੰਪਰਾਗਤ ਹੱਥ ਨਾਲ ਡਰਾਇੰਗ ਟੂਲਾਂ ਨੂੰ ਤਰ ਤਰਜੀਹ ਦਿੰਦੇ ਹਨ ਜਦੋਂ ਕਿ ਹੋਰ ਲੋਕ ਡਿਜੀਟਲ ਡਰਾਇੰਗ ਟੂਲਾਂ ਨੂੰ ਤਰਜੀਹ ਦਿੰਦੇ ਹਨ ਇਹ ਵਿਅਕਤੀਗਤ ਤਰਜੀਹ ਅਤੇ ਕੰਮ ਦੀਆਂ ਲੋੜਾਂ 'ਤੇ ਨਿਰਭਰ ਕਰਦਾ ਹੈ